ਪੰਜਾਬ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ ਇੱਥੋਂ ਦੇ ਜ਼ਿਆਦਾਤਰ ਪਰਿਵਾਰ ਖੇਤੀਬਾੜੀ ਉੱਪਰ ਹੀ ਨਿਰਭਰ ਕਰਦੇ ਨੇ ਖੇਤੀਬਾੜੀ ਹੀ ਉਨ੍ਹਾਂ ਦਾ ਇੱਕ ਪਹਿਲਾਂ ਧੰਦਾ ਹੈ ਅਤੇ ਪਰ ਹੁਣ ਦਿਨੋਂ ਦਿਨ ਬੀਜਾਂ ਦੀ ਮਹਿੰਗਾਈ ਰੇਹਾਂ ਸਪਰੇਹਾਂ ਅਤੇ ਖਾਦਾਂ ਦੀ ਮਹਿੰਗਾਈ ਦੇ ਕਾਰਨ ਜ਼ਿਆਦਾਤਰ ਖ਼ਰਚਾ ਹੋ ਰਿਹਾ ਹੈ ਅਤੇ ਉੱਪਰੋਂ ਫ਼ਸਲਾਂ ਦੀ ਝਾੜ ਹੁੰਦੀ ਨਹੀਂ ਜੋ ਉਨ੍ਹਾਂ ਦਾ ਬਹੁਤ ਜ਼ਿਆਦਾ ਘੱਟ ਰੇਟ ਮਿਲਦਾ ਹੈ ਜਿਸ ਕਰਕੇ ਦਿਨੋਂ ਦਿਨ ਖੇਤੀਬਾੜੀ ਨਾਲ ਸੰਬੰਧਿਤ ਪਰਿਵਾਰ ਕਰਜ਼ੇ ਦੀ ਮਾਰ ਹੇਠ ਆ ਰਹੇ ਹਨ ਜਿਸ ਕਰਕੇ ਲੋਕ ਇਸ ਧੰਦੇ ਵਿੱਚ ਉਲਝਣ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ